ਮੈਨੂੰ ਹਰਿਆਵਲ ਨਾਲ ਬਹੁਤ ਪਿਆਰ ਹੈ ਮੈਂ ਆਪਣੇ ਘਰ ਵਿੱਚ ਸਾਡੇ ਘਰ ਦੋ ਸੌ ਗੱਜ ਵਿੱਚ ਹੈ ਔਰ ਮੈਂ ਬਾਹਰ ਸਾਡੇ ਘਰ ਦੇ ਬਾਹਰ ਇੱਕ ਬਾਗ ਬਣਾਇਆ ਹੋਇਆ ਹੈ ਜਿਸਦੇ ਉੱਤੇ ਹਰਿਆਵਲ ਹੀ ਹਰਿਆਵਲ ਹੈ ਨੀਚੇ ਨੀਚੇ ਹਰਿਆਵਲ ਅਤੇ ਮੈਂ ਮੈਨੂੰ ਇੰਨਾ ਮੈਨੂੰ ਪੌਦਿਆਂ ਦਾ ਬਹੁਤ ਹੀ ਸ਼ੌਂਕ ਹੈ ਇਸ ਕਰਕੇ ਮੈਂ ਇੱਕ ਵਾਰ ਆਪਣਾ ਮਤਲਬ ਗੁਲਾਬ ਦਾ ਫੁੱਲ ਲਗਾਇਆ ਉਹਦੇ ਵਿੱਚ ਇੱਕ ਬੀਜ਼ ਲਿਆ ਕੇ ਗੁਲਾਬ ਦਾ ਫੁੱਲ ਦਾ ਬੀਜ਼ ਲਗਾਇਆ ਉਹਦੇ ਵਿੱਚ ਰੋਜ਼ ਮੈਂ ਉਹਨੂੰ ਪਾਣੀ ਦਿੰਦੀ ਸੀ ਹੌਲੀ ਹੌਲੀ ਕਰਕੇ ਉਹਦੇ ਵਿੱਚੋਂ ਥੋੜ੍ਹਾ ਜਿਹਾ ਪੱਤੇ ਨਿਕਲਣੇ ਸ਼ੁਰੂ ਹੋਏ ਗਰੀਨ ਗਰੀਨ ਫਿਰ ਕੁਛ ਦਿਨਾਂ ਬਾਅਦ ਥੋੜ੍ਹਾ ਥੋੜ੍ਹਾ ਵਿੱਚੋਂ ਡੋਡੀ ਉਹਦੇ ਨਿਕਲਣੀ ਸ਼ੁਰੂ ਹੋਈ ਫਲਾਰ ਨਜ਼ਰ ਆਉਣਾ ਸ਼ੁਰੂ ਹੋ ਗਿਆ ਥੋੜ੍ਹਾ ਥੋੜ੍ਹਾ ਉਹਦੀ ਓ ਖਿੜਦਾ ਵੇਖ ਕੇ ਮੇਰੇ ਦਿਲ ਨੂੰ ਇੰਨੀ ਖੁਸ਼ੀ ਹੋਈ ਇੰਨੀ ਖੁਸ਼ੀ ਹੋਈ ਹੌਲੀ ਹੌਲੀ ਕਰਦਿਆਂ ਉਹ ਇੱਕ ਗੁਲਾਬ ਦਾ ਫੁੱਲ ਖਿੜ ਗਿਆ ਵੱਡਾ ਉਹਦੀ ਸਮੇਲ ਇੰਨੀ ਅੱਛੀ ਇੰਨੀ ਚੰਗੀ ਲੱਗੀ ਮੈਨੂੰ ਮੈਂ ਹੌਲੀ ਹੌਲੀ ਕਰਦਿਆਂ ਇੱਕ ਦੋ ਦੋ ਤੋਂ ਕਿੰਨੇ ਹੀ ਗੁਲਾਬ ਹਰ ਇੱਕ ਤਰ੍ਹਾਂ ਦਾ ਗੁਲਾਬ ਲਗਾਇਆ ਇੰਨ ਮਤਲਬ ਮੈਨੂੰ ਬਹੁਤ ਹੀ ਖੁਸ਼ੀ ਮਿਲਣੀ ਕਿ ਮੈਂ ਮੇਰੇ ਹੱਥੋਂ ਇੱਕ ਪੌਦੇ ਦਾ ਜਨਮ ਹੋਇਆ ਮੈਨੂੰ ਮੈਂ ਮੈਨੂੰ ਬਹੁਤ ਹੀ ਜੋ ਬਗੀਚੇ ਵਿੱਚ ਪਾ ਪੇੜ ਪੌਦੇ ਜੋ ਵੀ ਹੈ ਮੈਨੂੰ ਬਹੁਤ ਅੱਛਾ ਲੱਗਦਾ ਹੈ ਮੇਰੇ ਦਿਲ ਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਸਾਡੇ ਘਰ ਦੇ ਵਿੱਚ ਛੋਟਾ ਜਿਹਾ ਬਾਗ ਹੈ ਉਹਦੇ 'ਚ ਨਿੱਕੇ ਨਿੱਕੇ ਫੁੱਲ ਪੇੜ ਪੌਦੇ ਲੱਗੇ ਹੋਏ ਹਨ ਉਹਦੇ ਉੱਤੇ ਅਸੀਂ ਸਵੇਰੇ ਉੱਠ ਕੇ ਮੈਂ ਸੈਰ ਵੀ ਕਰਦੀ ਹਾਂ ਉਸ ਸੈਰ ਓ ਸੈਰ ਕੀਤੀ ਹਰਿਆਵਲ ਦੇ ਉੱਤੇ ਸੈਰ ਕੀਤੀ ਆਪਣੇ ਸਰੀਰ ਨੂੰ ਬਹੁਤ ਤੰਦਰੁਸਤ ਰੱਖਦੀ ਹੈ ਔਰ ਵੇਖ ਕੇ ਹਰਿਆਵਲ ਵੇਖ ਕੇ ਬੜੀਆਂ ਬਿਮਾਰੀਆਂ ਬੜੀਆਂ ਦੂਰ ਹੁੰਦੀਆਂ ਹਨ ਬਿਮਾਰੀਆਂ ਬਹੁਤ ਦੂਰ ਹੁੰਦੀਆਂ ਹਨ ਇਸ ਕਰਕੇ ਸਾਨੂੰ ਆਪਣੇ ਘਰਾਂ ਵਿੱਚ ਪੇੜ ਪੌਦਿਆਂ ਨੂੰ ਲਗਾਉਣਾ ਚਾਹੀਦਾ ਹੈ ਪਰਮਾਤਮਾ ਵੀ ਕਹਿੰਦਾ ਜ਼ਿੰਦਗੀ ਵਿੱਚ ਆਪਣਾ ਆਪਣੇ ਹੱਥੀ ਇੱਕ ਰੁੱਖ ਜ਼ਰੂਰ ਲਗਾਉਣਾ ਚਾਹੀਦਾ ਹੈ ਅਸੀਂ ਇੰਨਾ ਮਤਲਬ ਬਹੁਤ ਮੈਨੂੰ ਖੁਸ਼ੀ ਮਹਿਸੂਸ ਹੁੰਦੀ ਹੈ ਉਹਨਾਂ ਨੂੰ ਪੇੜ ਪੌਦਿਆਂ ਨੂੰ ਦੇਖ ਕੇ ਉਹ ਵੀ ਇੱਕ ਤਰ੍ਹਾਂ ਦੇ ਜੀਵ ਨੇ ਜੀਵ ਨੇ ਜਿਸ ਤਰ੍ਹਾਂ ਅਸੀਂ ਜੀਵ ਹਾਂ ਸਾਡਾ ਜੀਵਨ ਆ ਅਸੀਂ ਮਨੁੱਖੀ ਜੀਵਨ ਹੈ ਪੇੜ ਪੌਦਿਆਂ ਦਾ ਵੀ ਜੀਵਨ ਹੁੰਦਾ ਹੈ ਉਹ ਵੀ ਸਾਡੇ ਵਾਂਗੂ ਸਾਹ ਲੈਂਦੇ ਨੇ ਉਹ ਵੀ ਸਵੇਰੇ ਖਿੜਦੇ ਨੇ ਕਈ ਪੌਦੇ ਇੱਦਾਂ ਹੁੰਦੇ ਨੇ ਸਵੇਰੇ ਖਿੜਦੇ ਨੇ ਸ਼ਾਮੀ ਮੁਰਝਾ ਜਾਂਦੇ ਨੇ ਮੈਂ ਬੜੀ ਤਰ੍ਹਾਂ ਦੇ ਫੁੱਲ ਲਗਾਏ ਆਪਣੇ ਬਾਗ ਦੇ ਵਿੱਚ ਫੁੱਲ ਲਗਾਏ ਹੋਣੇ ਜਿਨ੍ਹਾਂ ਦੀ ਸੇਵਾ ਮੈਂ ਰੋਜ਼ ਕਰਦੀ ਹੈ ਰੋਜ਼ ਉਹਨਾਂ ਨੂੰ ਮੈਂ ਪਾਣੀ ਦਿੰਦੀ ਹਾਂ ਹੌਲੀ ਹੌਲੀ ਕਰਕੇ ਉਹ ਗਰੋ ਮਤਲਬ ਪੌਦੇ ਵੱਧਦੇ ਫੁੱਲਦੇ ਨੇ ਜਿਨ੍ਹਾਂ ਨੂੰ ਦੇਖ ਕੇ ਆਪਣੇ ਮਨ ਨੂੰ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਤਾਨੂੰ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਆਪਣੇ ਜ਼ਿੰਦਗੀ ਦੇ ਵਿੱਚ ਬਾਗ ਬਗੀਚੇ ਨੂੰ ਖਿਡਾਉਣਾ ਚਾਹੀਦਾ ਹੈ ਧੰਨਵਾਦ